ਗਿਆਰਾਂ ਜਨਵਰੀ ਵੀਹ ਇੱਕੀ ਸੌਲਾਂ ਫਰਵਰੀ ਵੀਹ ਅਠਾਰਾਂ ਸਤਾਰਾਂ ਮਾਰਚ ਵੀਹ ਸਤਾਰਾਂ ਗਿਆਰਾਂ ਦਸੰਬਰ ਵੀਹ ਉੱਨੀ ਬਾਈ ਫਰਵਰੀ ਵੀਹ ਬਾਰਾਂ